ਤਿੰਨ ਫਰਵਰੀ ਉੱਨੀ ਸੌ ਤ੍ਰੇਹਠ ਪੰਜ ਨਵੰਬਰ ਉੱਨੀ ਸੌ ਸਤਾਸੀ ਦਸ ਦਸੰਬਰ ਉੱਨੀ ਸੌ ਨੱਬੇ ਬਾਰਾਂ ਸਤੰਬਰ ਉੱਨੀ ਸੌ ਤ੍ਰਿਆਨਵੇਂ ਪੰਜ ਜੁਲਾਈ ਦੋ ਹਜ਼ਾਰ ਇੱਕ